ਜਦੋਂ ਮੈਂ ਪਿਛਲੇ ਸਾਲ ਹਰਿਮੰਦਰ ਸਾਹਿਬ ਘੁੰਮਣ ਗਈ ਸੀ ਤਾਂ ਤਾਂ ਉੱਥੇ ਮੈਨੇ ਹਰਿਮੰਦਰ ਸਾਹਿਬ ਦੀ ਫੋਟੋ ਕਲਿੱਕ ਕੀਤੀ ਸੀ ਉਸ ਸਮੇਂ ਸ਼ਾਮ ਦਾ ਟਾਈਮ ਸੀ ਜਿਸ ਤੋਂ ਮੇਰਾ ਵਿਊ ਬਹੁਤ ਅੱਛਾ ਸੀ ਉਸ ਟਾਇਮ ਸੂਰਜ ਢਲ ਰਿਹਾ ਸੀ ਅਤੇ ਉਹ ਫੋਟੋ ਬਹੁਤ ਅੱਛੀ ਆਈ ਸੀ ਮੈਨੇ ਫੋਟੋਆਂ ਤਾਂ ਬਹੁਤ ਸਾਰੀਆਂ ਕਲਿੱਕ ਕੀਤੀਆਂ ਪਰ ਮੈਨੂੰ ਸਾਰੀਆਂ ਫੋਟੋਆਂ ਵਿੱਚੋਂ ਉਹ ਫੋਟੋ ਬਹੁਤ ਪਸੰਦ ਹੈ ਅਤੇ ਅੱਜ ਵੀ ਮੈਨੂੰ ਉਹ ਫੋਟੋ ਬਹੁਤ ਪਸੰਦ ਹੈ ਮੈਨੇ ਉਸ ਨੂੰ ਆਪਣੇ ਵੋਲਪੇਪਰ 'ਤੇ ਲਗਾਇਆ ਹੋਇਆ ਹੈ ਅਤੇ ਉਹ ਉਹ ਫੋਟੋ ਮੇਰੇ ਵੋਲਪੇਪਰ 'ਤੇ ਬਹੁਤ ਅੱਛੀ ਲੱਗਦੀ ਹੈ ਅਤੇ ਅੱਜ ਵੀ ਮੈਨੂੰ ਉਸ ਫੋਟੋ ਨੂੰ ਹਟਾਉਣ ਦਾ ਜੀਅ ਨਹੀਂ ਕਰਦਾ ਅਤੇ ਉਸ ਫੋਟੋ ਦੇ ਪਿੱਛੇ ਦੀ ਕਹਾਣੀ ਮੈਂ ਦੱਸਾਂ ਤਾਂ ਮੈਂ ਜਦ ਉੱਥੇ ਘੁੰਮਣ ਗਈ ਤਾਂ ਮੈਨੇ ਉਹ ਫੋਟੋ ਕਲਿੱਕ ਕਰੀ ਅਤੇ ਮੈਨੂੰ ਉਹ ਫੋਟੋ ਅੱਜ ਵੀ ਬਹੁਤ ਪਸੰਦ ਹੈ